ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਮੈਂ ਕੁਲਵੰਤ ਕੌਰ ਬੋਲਦੀ ਹਾਂ ਜੀ

ਹਾਂਜੀ ਹਾਂਜੀ ਹੁਣ ਤਾਂ ਬਿਲਕੁਲ ਸਹੀ ਹੈ ਜੀ ਹਾਂਜੀ ਹਾਂਜੀ ਹਾਂਜੀ ਹੁਣ ਮੈਂ ਬਿਲਕੁਲ ਠੀਕ ਹਾਂ ਦਵਾਈ ਲੈ ਲਈ ਸੀ ਨਾ ਤੁਹਾਡੇ ਤੋਂ ਤਾਂ ਹੁਣ ਮੈਂ ਬਿਲਕੁਲ ਸਹੀ ਹਾਂ ਹਾਂਜੀ ਹਾਂਜੀ ਹਾਂਜੀ ਸਟੀਮ ਵੀ ਲੈ ਰਹੀ ਹਾਂ ਦਵਾਈ ਵੀ ਖਾ ਰਹੀ ਹਾਂ ਅਤੇ ਬਾਕੀ ਆਪਣਾ ਪਰਹੇਜ਼ ਖਾਣ ਪੀਣ ਦਾ ਪਰਹੇਜ਼ ਵੀ ਕਰ ਰਹੀ ਹਾਂ ਹਾਂਜੀ ਹਾਂਜੀ ਹਾਂਜੀ ਉਹ ਹੀ ਖਾਂਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਹਾਂ ਜੀ ਹੁਣ ਤਾਂ ਹਾਂਜੀ ਠੀਕ ਹੈ ਜੀ ਠੀਕ ਹੈ ਬਸ ਆਹੀ ਸੀਗੇ ਮੈਮ ਜਿਹੜੇ ਰੇਸ਼ੇ ਜ਼ੁਕਾਮ ਸੀ ਬਸ ਇਸ ਦਾ ਹੀ ਪੁੱਛਣਾ ਸੀਗਾ ਇਸ ਦੀ ਮੈਂ ਤੁਹਾਡੇ ਤੋਂ ਦਵਾਈ ਲੈ ਆਈ ਸੀਗੀ ਅਤੇ ਹੁਣ ਮੈਂ ਬਿਲਕੁਲ ਠੀਕ ਹਾਂ ਅਤੇ ਬਾਕੀ ਮੈਂ ਆਪਣਾ ਵੀ ਪਰਹੇਜ਼ ਵਗੈਰਾ ਰੱਖਦੀ ਹਾਂ ਖਾਣ ਪੀਣ ਦਾ ਹਾਂਜੀ ਫਿਰ ਉਹਦੇ ਕਰਕੇ ਹੁਣ ਮੈਨੂੰ ਹਾਂਜੀ ਠੀਕ ਹੈ ਮੈਮ ਓਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਮਾਸਕ ਲੈ ਕੇ ਜਾਂਦੀ ਹਾਂ ਮੈਮ ਕਿਤੇ ਵੀ ਜਾਵਾਂ ਮਾਸਕ ਲੈ ਕੇ ਜਾਂਦੀ ਹਾਂ ਆਪਣਾ ਅਤੇ ਹਾਂਜੀ ਤਾਂ ਬਾਕੀ ਜੋ ਮੈਨੂੰ ਲੋੜ ਹੋਈ ਫਿਰ ਮੈਂ ਤੁਹਾਨੂੰ ਫਿਰ ਮੈਂ ਦੁਬਾਰੇ ਮਿਲੂੰਗੀ ਤਾਂ ਤੁਸੀਂ ਉੱਥੇ ਹੁੰਦੇ ਹੋ ਹੋਸਪੀਟਲ 'ਚ ਹੁੰਦੇ ਹੋ ਕੋਈ ਡਿਸਪੈਂਸਰੀ 'ਚ ਹੁੰਦੇ ਹੋ ਅੱਛਾ ਜੀ

ਹਾਂਜੀ ਠੀਕ ਹੈ ਜੀ ਮੇਹਰਬਾਨੀ ਬਹੁਤ ਬਹੁਤ ਮੈਮ ਤੁਹਾਡੀ ਜੀ ਠੀਕ ਆ ਹਾਂਜੀ ਓਕੇ ਓਕੇ ਜੀ ਓਕੇ